ਰੂਪਨਗਰ ਦੀ ਜਿਹੜੀ ਵੱਡੀ ਤੋਂ ਵੱਡੀ ਸਮੱਸਿਆ ਉਹ ਸਫਾਈ ਦੀ ਆ ਸਫਾਈ ਨਾ ਰਹਿਣ ਕਰਕੇ ਬਿਮਾਰੀਆਂ ਹੁੰਦੀਆਂ ਬਿਮਾਰੀਆਂ ਹੋਣ ਕਰਕੇ ਡਾਕਟਰਾਂ ਕੋਲ ਪਹੁੰਚਿਆ ਜਾਂਦਾ ਤਾਂ ਅਸੀਂ ਜਿਹੜੇ ਸਰਕਾ ਲੀਡਰ ਨੇ ਲੀਡਰਾਂ ਤੋਂ ਅਸੀਂ ਇਹੀ ਰਿਕੁਏਸਟ ਕਰਦੇ ਹਾਂ ਕਿ ਉਹ ਸਫਾਈ ਲਈ ਪ੍ਰਬੰਧ ਕਰਨ ਧੰਨ